ਭਾਰਤ ਦੇ ਦੂਜੇ ਰਾਜਾਂ ਜਾਂ ਖੇਤਰਾਂ ਦੀ ਤੁਲਨਾ ਵਿੱਚ ਪੰਜਾਬ ਵਿੱਚ ਵਪਾਰਕ ਮਾਹੌਲ ਇਸ ਦੀਆਂ ਵਿਲੱਖਣ ਸ਼ਕਤੀਆਂ ਅਤੇ ਚੁਣੌਤੀਆਂ ਦੁਆਰਾ ਦਰਸਾਇਆ ਗਿਆ ਹੈ ਪੰਜਾਬ ਵਿੱਚ ਲਘੂ ਉਦਯੋਗਾਂ ਦਾ ਮਜ਼ਬੂਤ ਅਧਾਰ ਹੈ ਜੋ ਕਿ ਇਹਦੀ ਆਰਥਿਕ ਸਥਿਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਇਹ ਉਦਯੋਗ ਖੇਤੀ ਨਿਰਮਾਣ ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ਸਮੇਤ ਵਿਭਿੰਨਤਾ ਵਾਲੇ ਹਨ ਖ਼ਾਸ ਤੌਰ 'ਤੇ ਪੰਜਾਬ ਲਗਭਗ ਦੋ ਸੌ ਟੈਨਰੀਆਂ ਦੀ ਮੇਜਬਾਨੀ ਕਰਦਾ ਹੈ ਮੁੱਖ ਤੌਰ 'ਤੇ ਜਲੰਧਰ ਅਤੇ ਅੰਬਰੂ ਸ਼ਹਿਰਾਂ ਵਿੱਚ ਕੇਂਦਰਿਤ ਜੋ ਰੁਜ਼ਗਾਰ ਆਦਿ ਨਿਰਯਾਤ ਦੁਆਰਾ ਸਥਾਨਕ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਹਾਲਾਂਕਿ ਪੰਜਾਬ ਦੇ ਵਪਾਰਕ ਮਾਹੌਲ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਜ ਬੁਨਿਆਦੀ ਢਾਂਚੇ ਦੇ ਮੁੱਦਿਆਂ ਨਾਲ ਸੰਘਰਸ਼ ਕਰ ਰਿਹਾ ਹੈ ਜਿਸ ਵਿੱਚ ਪੁਰਾਣੇ ਲੋਜਿਸਟਿਕਸ ਅਤੇ ਆਵਾਜਾਈ ਨੈਟਵਰਕ ਸ਼ਾਮਲ ਹਨ ਜੋ ਉਦਯੋਗਾਂ ਦੀ ਕੁਸ਼ਲਤਾ ਵਿੱਚ ਰੁਕਾਵਟ ਪਾ ਸਕਦੇ ਹਨ ਇਸ ਤੋਂ ਇਲਾਵਾ ਰੈਗੂਲੇਟਰੀ ਅਤੇ ਨੌਕਰਸ਼ਾਹੀ ਰੁਕਾਵਟਾਂ ਕਾਰੋਬਾਰ ਕਰਨ ਦੀ ਸੌਖ ਨੂੰ ਪ੍ਰਭਾਵਿਤ ਕਰ ਸਕਦੇ ਹਨ ਗੁਜਰਾਤ ਜਾਂ ਮਹਾਰਾਸ਼ਟਰ ਵਰਗੇ ਰਾਜਾਂ ਦੇ ਮੁਕਾਬਲੇ ਜੋ ਵਧੇਰੇ ਵਿਕਸਿਤ ਬੁਨਿਆਦੀ ਢਾਂਚੇ ਅਤੇ ਵਧੇਰੇ ਸੁਚਾਰੂ ਰੈਗੂਲੇਟਰੀ ਢਾਂਚੇ ਦਾ ਮਾਣ ਰੱਖਦੇ ਹਨ ਪੰਜਾਬ ਦਾ ਵਪਾਰਕ ਮਾਹੌਲ ਘੱਟ ਮੁਕਾਬਲੇ ਵਾਲਾ ਹੈ ਇਹਨਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦਾ ਮਜ਼ਬੂਤ ਉਦਯੋਗਿਕ ਆਧਾਰ ਰਾਜਨੀਤਿਕ ਸਥਿਤੀ ਅਤੇ ਅਮੀਰ ਖੇਤੀ ਸਰੋਤ ਵਿਕਾਸ ਅਤੇ ਵਿਕਾਸ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ ਜੇਕਰ ਟੀਚਾ ਨੀਤੀਗਤ ਦਖ਼ਲ ਅੰਦਾਜੀ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਦੁਆਰਾ ਪੂਰਵਕ ਕੀਤਾ ਜਾਂਦਾ ਹੈ ਤਾਂ ਇਹ ਸੰਭਵ ਤੌਰ 'ਤੇ ਹੀ ਸਹੀ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ